ਦੇਖੋ ਜੀ ਸਾਡੀ ਖੁਰਾਕ ਦੇ ਵਿੱਚ ਸਵੇਰ ਨੂੰ ਉੱਠ ਕੇ ਪਹਿਲਾਂ ਅਸੀਂ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਬਦਾਮ ਲਈ ਦੇ ਹੈ ਪਹਿਲਾਂ ਜਿਹਨੂੰ ਬਹੁਤ ਸਾਰੇ ਵੈਦ ਵੀ ਦੱਸਦੇ ਆ ਕਿ ਖਾਲੀ ਪੇਟ ਪੰਜ ਬਦਾਮ ਖਾਓ ਉਹ ਸਾਰਾ ਦਿਨ ਤੁਹਾਨੂੰ ਐਨਰਜੀ ਦੇਣਗੇ ਘੰਟਾ ਡੇਢ ਘੰਟਾ ਬੀਤਣ ਤੋਂ ਬਾਅਦ ਫਿਰ ਨਾਸ਼ਤਾ ਕਰੀਦਾ ਲਾਸਟ ਦੇ ਵਿੱਚ ਦਹੀਂ ਅਤੇ ਨਾਲ਼ ਸਿੰਪਲ ਰੋਟੀ ਜਾਂ ਕਈ ਵਾਰੀ ਪੰਜਾਬੀਆਂ ਦੀ ਜਿਹੜੀ ਖਾਦ ਖੁਰਾਕ ਹੈ ਬਈ ਆਲੂ ਵਾਲਾ ਪਰੌਂਠਾ ਅੱਜ ਕੱਲ੍ਹ ਮੇਥੀ ਹੈ ਮੇਥੀ ਵਾਲ਼ਾ ਪਰੌਂਠਾ ਅਤੇ ਉਸ ਤੋਂ ਬਾਅਦ ਸਰਦੀਆਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਖੁਰਾਕ ਬੜੀ ਮਸ਼ਹੂਰ ਹੈ ਸਾਗ ਅਤੇ ਮੱਕੀ ਦੀ ਰੋਟੀ ਇਹ ਸਾਗ ਅਤੇ ਮੱਕੀ ਦੀ ਰੋਟੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਜਾ ਕੇ ਦੇਖੋ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ ਅਤੇ ਦੂਜੇ ਜਿਹੜੇ ਸੂਬਿਆਂ ਵਾਲ਼ੇ ਲੋਕ ਹੈ ਉਹ ਵੀ ਇਹ ਇਹਨੂੰ ਬੜੀ ਅੱਛੀ ਮੰਨਦੇ ਕਿਉਂਕਿ ਇਹ ਹਰੀ ਖੁਰਾਕ ਹੈ ਔਰ ਹਰੀਆਂ ਸਬਜ਼ੀਆਂ ਜਿਹਨੂੰ ਬਿਲਕੁਲ ਪੱਤੇ ਵਾਲ਼ੀ ਹੁੰਦੀ ਹੈ ਉਹ ਸਾਗ ਉਹਦਾ ਬਣਦਾ ਉਹਦੇ ਵਿੱਚ ਫਿਰ ਮੱਖਣ ਵੀ ਪਾ ਲੈਂਦੇ ਆ ਦੇਸੀ ਘਿਓ ਵੀ ਪਾ ਲੈਂਦੇ ਆ ਅਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਅਸੀਂ ਹੈ ਸਬਜ਼ੀਆਂ ਨੂੰ ਵੀ ਤਰਜੀਹ ਦਿੰਦੇ ਹਾਂ ਚਾਵਲ ਘੱਟ ਖਾਂਦੇ ਹਾਂ ਔਰ ਚੰਗੀ ਕੁਆਲਿਟੀ ਦਾ ਜਿਹੜਾ ਉਹ ਭੋਜਨ ਮਿਲਦਾ ਉਹ ਭੋ ਚੰਗੀ ਕੁਆਲਿਟੀ ਦਾ ਭੋਜਨ ਮਿਲਣ ਦੇ ਨਾਲ਼ ਹੀ ਪੰਜਾਬੀਆਂ ਦੇ ਜਿਹੜੇ ਜੁੱਸੇ ਹੈ ਉਹ ਅਕਸਰ ਵਧੀਆ ਦੇਖਣ ਨੂੰ ਮਿਲਦੇ ਆ ਇਹਨਾਂ ਦੀ ਸਿਹਤ ਵੀ ਵਧੀਆ ਦੇਖਣ ਨੂੰ ਮਿਲਦੀ ਆ ਇਸੇ ਕਰਕੇ ਕਹਿ ਪੰਜਾਬੀ ਨੂੰ ਕਿਹਾ ਜਾਂਦਾ ਵੀ ਬੜਾ ਵਧੀਆ ਸਿਹਤ ਪੱਖੋਂ ਨਰੋਆ ਵਿਅਕਤੀ ਹੈ ਕਿਉਂਕਿ ਜੇ ਚੰਗੀ ਖੁਰਾਕ ਹੈ ਤਾਂ ਹੀ ਇਹ ਕਬੱਡੀ ਖੇਡਦਾ ਇਹ ਫੁੱਟਬਾਲ ਖੇਡਦਾ ਹਾਕੀ ਖੇਡਦਾ ਬਹੁਤ ਸਾਰੇ ਨਾਮਵਰ ਜਿਹੜੇ ਉਹ ਖਿਡਾਰੀ ਚਾਹੇ ਉਹ ਹਾਕੀ ਦੇ ਹੋਏ ਚਾਹੇ ਫੁੱਟਬਾਲ ਦੇ ਹੋਏ ਜਾਂ ਕਬੱਡੀ ਦੇ ਹੋਏ ਉਹ ਪੰਜਾਬ ਦੇ ਵਿੱਚੋਂ ਹੋਏ ਆ ਅੱਜ ਕੱਲ੍ਹ ਇੰਟਰਨੈਸ਼ਨਲ ਪੱਧਰ ਦੀ ਜਿਹੜੀ ਸਾਡੇ ਨੈਸ਼ਨਲ ਪੱਧਰ ਦੀ ਕ੍ਰਿਕਟ ਟੀਮ ਹੈ ਉਹਦੇ ਵਿੱਚ ਵੀ ਪੰਜਾਬੀ ਖਿਡਾਰੀ ਜਿਹੜੇ ਹੈ ਉਹ ਆਪਣਾ ਖੇਡ ਦਾ ਲੋਹਾ ਮਨਵਾ ਰਹੇ ਆ ਇਹ ਸਾਰਾ ਕੁਝ ਚੰਗੀ ਖੁਰਾਕ ਕਰਕੇ ਹੀ ਹੈ ਕਿ ਚੰਗੀ ਖੁਰਾਕ ਲੈਂਦੇ ਆ ਉਹਦੇ ਕਰਕੇ ਇਹ ਆਉਣ ਆਉਣ ਆਲੇ ਸਮੇਂ ਦੇ ਵਿੱਚ ਵੀ ਔਰ ਪਿਛਲੇ ਸਮਿਆਂ ਦੇ ਵਿੱਚ ਵੀ ਇਹਨਾਂ ਨੇ ਚੰਗੀ ਖੁਰਾਕ ਦੀ ਵਜ੍ਹਾ ਕਰਕੇ ਆਪਣੀ ਸਿਹਤ ਵਧੀਆ ਰੱਖਣ ਕਰਕੇ ਪੂਰੇ ਵਿਸ਼ਵ ਭਰ ਦੇ ਵਿੱਚ ਧੁੰਮਾਂ ਪਹੁੰਚਾਈਆਂ